ਮੀਡੀਆ ਅਤੇ ਇੰਟਰਨੈਟ ਨੇ ਕਾਰੋਬਾਰ ਵਿੱਚ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ ਪਹਿਲਾਂ ਆਪਾਂ ਆਪਦੇ ਕਾਰੋਬਾਰ ਨੂੰ ਵਧਾਉਣ ਲਈ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਦਿੰਦੇ ਸੀ ਪਰ ਹੁਣ ਔਨਲਾਈਨ ਹੋਣ ਕਰਕੇ ਆਪਾਂ ਅਲੱਗ ਅਲੱਗ ਐਪ ਖੋਲ੍ਹ ਕੇ ਉਸ ਵਿੱਚ ਆਪਦੇ ਪ੍ਰੋਡਕਟ ਨੂੰ ਘਰ ਬੈਠੇ ਆਰਾਮ ਨਾਲ ਵੇਚ ਸਕਦੇ ਹਾਂ ਅਤੇ ਇਸ ਨਾਲ ਆਪਣੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪ੍ਰੋਡਕਟ ਵੀ ਸਹੀ ਟਾਈਮ 'ਤੇ ਬੰਦਿਆਂ ਤੱਕ ਪਰਸਨਸ ਤੱਕ ਪਹੁੰਚਾਇਆ ਜਾ ਸਕਦਾ ਹੈ ਮੀਡੀਆ ਅਤੇ ਇੰਟਰਨੈਟ ਨੇ ਆਪਣੇ ਪ੍ਰੋਡਕਟ ਦੀ ਮਸ਼ਹੂਰੀ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ ਜਿਵੇਂ ਆਪਾਂ ਅਗਰ ਕਿਸੇ ਸੋਸ਼ਲ ਮੀਡੀਆ 'ਤੇ ਕੋਈ ਵੀਡੀਓ ਪਲੇ ਕਰਦੇ ਹਾਂ ਤਾਂ ਉਸ 'ਤੇ ਆਪਾਂ ਨੂੰ ਅਲੱਗ ਅਲੱਗ ਐਪਸ ਤੋਂ ਅਲੱਗ ਅਲੱਗ ਪ੍ਰੋਡਕਟਸ ਦੀ ਮਸ਼ਹੂਰੀ ਦਿਖਾਈ ਜਾਂਦੀ ਹੈ ਇਸ ਤਰ੍ਹਾਂ ਆਪਣਾ ਪ੍ਰੋਡਕਟ ਬਹੁਤ ਹੀ ਜ਼ਿਆਦਾ ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦਾ ਹੈ ਅਤੇ ਆਪਣੀ ਬਹੁਤ ਜ਼ਿਆਦਾ ਮਦਦ ਕਰਦਾ ਗਾ ਬਿਜ਼ਨਸ ਨੂੰ ਵਧਾਉਣ ਵਿੱਚ